ਮੇਰਾ ਨਾਮ ਬਸੰਤ ਕੁਮਾਰ ਹੈ ਮੈਂ ਪ੍ਰੇਮ ਨਗਰ ਆਸਰੋ ਪਿੰਡ ਦਾ ਰਹਿਣ ਵਾਲਾ ਹਾਂ ਮੈਂ ਕੁਝ ਦਿਨ ਪਹਿਲਾਂ ਫਲਿੱਪਕਾਰਟ ਐਪ ਤੋਂ ਕੱਪੜੇ ਔਡਰ ਕਰਵਾਏ ਸੀ ਕਿਉਂਕਿ ਮੇਰੇ ਭੈਣ ਦਾ ਵਿਆਹ ਸੀ ਅਤੇ ਮੈਂ ਔਨਲਾਈਨ ਪੇਮੈਂਟ ਵੀ ਪਹਿਲਾਂ ਹੀ ਕਰ ਦਿੱਤੀ ਸੀ ਪਰ ਮੈਨੂੰ ਉਹ ਕੱਪੜੇ ਟਾਈਮ ਸਿਰ ਵਿਆਹ 'ਚ ਨਹੀਂ ਮਿਲੇ ਜਿਸ ਕਰਕੇ ਮੈਨੂੰ ਵਿਆਹ ਤੋਂ ਟਾਇਮ ਕੱਢ ਕੇ ਬਾਜ਼ਾਰ ਜਾਣਾ ਪੈ ਗਿਆ ਅਤੇ ਅਲੱਗ ਤੋਂ ਸ਼ੂਜ਼ ਲੈਣੇ ਪੈ ਗਏ ਅਤੇ ਜਿਸ ਕਰਕੇ ਮੈਨੂੰ ਇੱਕ ਤਾਂ ਬੜਾ ਗੁੱਸਾ ਕਿਉਂਕਿ ਮੈਂ ਪੇਮੈਂਟ ਵੀ ਪਹਿਲਾਂ ਕਰ ਦਿੱਤੀ ਸੀ ਅਤੇ ਮੈਨੂੰ ਚੀਜ਼ ਵੀ ਟਾਈਮ ਦੀ ਨਹੀਂ ਮਿਲੀ ਅਤੇ ਜਦ ਮੈਨੂੰ ਉਹ ਸ਼ੂਜ਼ ਪ੍ਰਾਪਤ ਹੋਏ ਓਦੋਂ ਮੇਰਾ ਵਿਆਹ ਵੀ ਭੈਣ ਦਾ ਵਿਆਹ ਵੀ ਨਿਕਲ ਗਿਆ ਸੀ ਅਤੇ ਉਸ ਕਰਕੇ ਮੈਨੂੰ ਹੋਰ ਗੁੱਸਾ ਆਇਆ ਅਤੇ ਜਦ ਮੈਂ ਉਹ ਸੂਜ਼ ਪਾ ਕੇ ਦੇਖੀ ਤਾਂ ਉਹਦਾ ਸਾਈਜ਼ ਵੀ ਘੱਟ ਵੱਧ ਸੀਗਾ ਜਿਸ ਕਰਕੇ ਮੈਨੂੰ ਹੋਰ ਮਤਲਬ ਮੈਨੂੰ ਇਹ ਤੁਹਾਡਾ ਸਿਸਟਮ ਠੀਕ ਨਹੀਂ ਲੱਗਾ ਮੈਂ ਉਸ ਡੀਲਰ ਨਾਲੋਂ ਵੀ ਦੋ ਚਾਰ ਮੇਰੀਆਂ ਗੱਲਾਂ ਹੋ ਗਈਆਂ ਗੁੱਸੇ 'ਚ ਮੇਰੀ ਤੁਹਾਡੇ ਨਾਲ ਬੇਨਤੀ ਹੈਗੀ ਅੱਗੇ ਤੋਂ ਜੇ ਤੁਸੀਂ ਪੇਮੈਂਟ ਪਹਿਲੇ ਲੈ ਲੈਂਦੇ ਹੋ ਤਾਂ ਉਹ ਡਿਲੀਵਰੀ ਵੀ ਤੁਸੀਂ ਟਾਇਮ ਦੀ ਕਰ ਦਿਆ ਕਰੋ ਤਾਂ ਕਿ ਅਗਲੇ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਉਹ ਉਸ ਚੀਜ਼ ਦਾ ਟਾਇਮ ਸਿਰ ਪ੍ਰਯੋਗ ਕਰ ਸਕੇ